ਭੰਗੜਾ ਇੱਕ ਸਾਡਾ ਲੋਕ ਨਾਚ ਹੈ ਪੰਜਾਬੀ ਕਲਚਰ ਹੈ ਇਹਦੇ ਤੋਂ ਸਾਨੂੰ ਸਾਡੇ ਬੱਚੇ ਭੰਗੜਾ ਪਾਉਂਦੇ ਹਨ ਅਤੇ ਖੂਬ ਐਟਰਟੇਂਨਮੈਂਟ ਕਰਦੇ ਹਨ ਆਪਣਾ ਮੰਨੋਰੰਜਨ ਕਰਦੇ ਹਨ ਐਰੋਬਿਕਸ ਐਰੋਬਿਕਸ ਪੰਜਾਬ ਦਾ ਇੱਕ ਨਵੇਂ ਤਰੀਕੇ ਦਾ ਨਾਚ ਹੈ ਜਿਹੜਾ ਕਿ ਮੈਨੂੰ ਅੱਛਾ ਲੱਗਦਾ ਕਿ ਮੇਰੇ ਬੱਚੇ ਕਰਕੇ ਆਉਂਦੇ ਹਨ ਅਤੇ ਉਹਨਾਂ ਦੀ ਐਕਸਰਸਾਈਜ਼ ਹੁੰਦੀ ਹੈ ਯੋਗਾ ਵਗੈਰਾ ਸਭ ਕੁਝ ਇਹਦੇ ਵਿੱਚ ਆ ਜਾਂਦਾ ਹੈ ਇਹ ਇੱਕ ਤੇਜ਼ ਤੇਜ਼ ਗਾਣੇ ਦੇ ਉੱਤੇ ਨਾਚ ਹੈਗਾ ਵਾ ਜਿਹੜਾ ਕਿ ਬੱਚੇ ਸੋਹਣੇ ਢੰਗ ਨਾਲ ਕਰਦੇ ਹਨ ਅਤੇ ਮੈਨੂੰ ਬਹੁਤ ਅੱਛਾ ਲੱਗਦਾ ਕਿ ਮੇਰੇ ਬੱਚੇ ਕਰਕੇ ਆਉਂਦੇ ਹਨ ਕਰਕੇ ਆਉਂਦੇ ਹਨ ਲੋਕ ਨਾਚ ਕਰਕੇ ਆਉਂਦੇ ਹਨ ਅਤੇ ਉਹ ਆਪਣਾ ਬਹੁਤ ਸੋਹਣਾ ਇਹਦੇ ਵਿੱਚ ਰ ਅਰ ਅਰੋਬਿਕਸ ਭੰਗੜਾ ਸਭ ਵਧੀਆ ਤਰੀਕੇ ਨਾਲ ਕਰਦੇ ਹਨ ਇਹ ਮੈਨੂੰ ਭੰਗੜੇ ਤੋਂ ਵੀ ਜ਼ਿਆਦਾ ਵਧੀਆ ਲੱਗ ਰਿਹਾ ਹੈ ਕਿ ਸੋਹਣੇ ਢੰਗ ਨਾਲ ਮੇਰੇ ਬੱਚੇ ਸਿੱਖ ਕੇ ਆਉਂਦੇ ਨੇ ਔਰ ਮੈਨੂੰ ਅੱਛਾ ਲੱਗਦਾ ਕਿ ਉਹ ਘਰ ਆ ਕੇ ਵੀ ਆਪਣਾ ਸਾਰਾ ਇੱਕ ਦੂਜੇ ਦੇ ਨਾਲ ਐਕਸਰਸਾਈਜ਼ਾਂ ਕਰਦੇ ਹਨ ਅਤੇ ਭੰਗੜਾ ਤਾਂ ਆਪਣਾ ਹੈਗਾ ਹੀ ਹੈ ਲੋਕ ਨਾਚ ਉਹ ਤਾਂ ਹੈ ਹੀ ਸਭ ਤੋਂ ਵਧੀਆ ਕਿ ਬੱਚੇ ਭੰਗੜਾ ਕਰਦੇ ਨੇ ਆਪਣੇ ਮੰਨੋਰੰਜਨ ਕਰਦੇ ਨੇ ਅਤੇ ਇਹ ਭੰਗੜੇ ਤੋਂ ਵੀ ਵੱਧ ਕੇ ਮੈਨੂੰ ਪਸੰਦ ਆਇਆ ਐਰੋਬਿਕਸ ਕਿ ਬੱਚੇ ਤੇਜ਼ ਤੇਜ਼ ਗਾਣਿਆ 'ਤੇ ਡਾਂਸ ਕਰਦੇ ਨੇ ਆਪਣੀ ਐਕਸਸਾਈਜ਼ ਕਰਦੇ ਆਪਣਾ ਤੰਦਰੁਸਤ ਰਹਿੰਦੇ ਨੇ ਆਪਣਾ ਟਾਈਮ ਪਾਸ ਕਰਦੇ ਨੇ ਅਤੇ ਬਾਹਰ ਅੰਦਰ ਜਾਣ ਨਾਲੋਂ ਚੰਗਾ ਕੀ ਹੈ ਐਰੋਬਿਕਸ ਕਰ ਲੈਂਦੇ ਨੇ ਘਰ ਦੇ ਵਿੱਚ